ਮੈਂ ਕੱਲ੍ਹ ਰਾਤ ਨੂੰ ਉਬਰ ਤੋਂ ਬੁਕਿੰਗ ਕਰਵਾਈ ਸੀ ਮੈਂ ਏਅਰਪੋਰਟ ਰੋਡ ਤੋਂ ਵਾਪਿਸ ਆਪਣੇ ਘਰ ਤਰਨਤਾਰਨ ਆਉਣਾ ਸੀ ਤਕਰੀਬਨ ਸਾਢੇ ਕੁ ਦਸ ਵੱਜੇ ਹੋਣਗੇ ਮੈਂ ਉਸ ਵੇਲੇ ਆਪਣੇ ਘਰ ਵਾਪਿਸ ਜਾਣਾ ਸੀ ਦਸ ਵੱਜ ਕੇ ਟਵੰਟੀ ਨਾਇਨ ਮਿੰਨਟ 'ਤੇ ਹੀ ਡਰਾਈਵਰ ਮੇਰੇ ਔਫਿਸ ਦੇ ਬਾਹਰ ਖਲੋ ਗਿਆ ਅਤੇ ਮੈਨੂੰ ਫ਼ੋਨ ਕਰਕੇ ਮੈਨੂੰ ਬੁਲਾਇਆ ਕਿ ਮੈਂ ਆ ਗਿਆ ਹਾਂ ਅਤੇ ਮੈਂ ਜਦੋਂ ਗਈ ਉਸਨੇ ਕਾ ਗੇਟ ਖੋਲ੍ਹਿਆ ਕਾਰ ਦਾ ਅਤੇ ਮੈਨੂੰ ਅੰਦਰ ਬਿਠਾਇਆ ਫਿਰ ਉਹ ਉਸਨੇ ਮੈਨੂੰ ਸੁਰੱਖਿਅਤ ਤਰੀਕੇ ਦੇ ਨਾਲ ਘਰ ਪਹੁੰਚਾਇਆ ਅਤੇ ਜਿੰਨੀ ਦੇਰ ਤੱਕ ਮੇਰੇ ਘਰ ਦਾ ਦਰਵਾਜ਼ਾ ਨਹੀਂ ਖੁੱਲ੍ਹਾ ਡਰਾਈਵਰ ਉੱਥੋਂ ਨਹੀਂ ਹਿੱਲਿਆ ਡਰਾਈਵਰ ਨੂੰ ਪਤਾ ਸੀ ਕਿ ਅੱਜ ਕੱਲ੍ਹ ਦਾ ਮਾਹੌਲ ਕਿਸ ਤਰ੍ਹਾਂ ਦਾ ਵਾ ਕੁੜੀਆਂ ਨੂੰ ਸੇਫਟੀ ਕਿਵੇਂ ਦੇਣੀ ਹੈ ਐਂਡ ਉੱਥੇ ਉਬਰ ਦੀ ਇੱਕ ਸਭ ਤੋਂ ਵਧੀਆ ਸਰਵਿਸ ਇਹ ਹੈਗੀ ਸੀ ਕਿ ਉੱਥੇ ਇੱਕ ਟਰੈਕਿੰਗ ਲੋਕੇਸ਼ਨ ਦਾ ਦਿੱਤਾ ਹੁੰਦਾ ਵੈ ਕਿ ਜੇ ਕੋਈ ਡਰਾਈਵਰ ਮਤਲਬ ਇੱਧਰ ਤੋਂ ਉੱਧਰ ਲੈ ਕੇ ਜਾਂਦਾ ਵਾ ਉੱਥੇ ਐਪ ਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਵਾ ਕਿ ਕਿੱਧਰ ਜਾ ਰਿਹਾ ਵਾ ਅਤੇ ਮੈਂ ਉਬਰ ਦਾ ਉਬਰ ਦੀ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਉਹਨੇ ਮੈਨੂੰ ਸੇਫਲੀ ਮੇਰੇ ਘਰ ਪਹੁੰਚਾ ਦਿੱਤਾ